ਅਸੀਂ ਵੀ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜੋ ਕਿ ਸਾਨੂੰ ਸੱਚਮੁੱਚ ਸੋਚਣ ਅਤੇ ਉਕਸਾਉਣ ਬਾਰੇ ਲੱਗੀ ਹੈ ਇਹ ਉਹ ਕਿਤਾਬ ਹੈ ਜਿਹੜੀ ਜੇਲ ਚਿੱਠੀਆਂ ਵਿੱਚ ਇੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਲਿਖੀ ਹੈ ਇਸ ਇਸ ਕਿ ਇਹ ਇਸ ਕਿਤਾਬ ਵਿੱਚ ਭਾਈ ਸਾਹਿਬ ਜੀ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਜੀ ਬਹੁਤ ਬਿਮਾਰ ਹਨ ਅਤੇ ਡੋਕਟਰਾਂ ਨੇ ਕਿਹਾ ਕਿ ਇਹਨਾਂ ਦਾ ਬੁਖਾਰ ਨਹੀਂ ਉੱਤਰ ਰਿਹਾ ਭਾਈ ਤਨਵੀਰ ਜੀ ਜੋ ਕਿ ਬੜੀ ਸ਼ਰਧਾ ਨਾਲ ਪ੍ਰਭੂ ਚਰਨਾਂ ਵਿੱਚ ਲੀਨ ਹੋ ਕੇ ਆਪਣੇ ਬਿਮਾਰ ਪਿਤਾ ਜੀ ਨੂੰ ਬੜੀ ਸ਼ਰਧਾ ਨਾਲ ਜਪੁਜੀ ਸਾਹਿਬ ਜੀ ਦਾ ਪਾਠ ਸੁਣਾ ਰਹੇ ਸਨ ਉਹ ਆਪਣੇ ਬਾਣੀ ਵਿੱਚ ਇੰਨੇ ਲੀਨ ਹੋ ਗਏ ਕਿ ਜਦੋਂ ਉਹਨਾਂ ਨੇ ਆਪਣੇ ਨੇਤਰ ਖੋਲ੍ਹੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪਿਤਾ ਜੀ ਬਹੁਤ ਪਸੀਨਾ ਵੱਗ ਰਿਹਾ ਸੀ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਹੱਥ ਲਾ ਕੇ ਵੇਖਿਆ ਤਾਂ ਉਹਨਾਂ ਦਾ ਬੁਖਾਰ ਉੱਤਰ ਗਿਆ ਉਹਨਾਂ ਨੇ ਜਾ ਕੇ ਡਾਕਟਰ ਨੂੰ ਫੋਨ ਕੀਤਾ ਅਤੇ ਕਿਹਾ ਤੁਸੀਂ ਮੇਰੇ ਪਿਤਾ ਜੀ ਨੂੰ ਆ ਕੇ ਦੇਖੋ ਜਦੋਂ ਡਾਕਟਰ ਸਾਹਿਬ ਘਰ ਆਏ ਉਹਨਾਂ ਨੇ ਪਿਤਾ ਜੀ ਨੂੰ ਚੈੱਕ ਕੀਤਾ ਤਾਂ ਉਹ ਬਹੁਤ ਹੈਰਾਨ ਹੋ ਗਏ ਤੁਸੀਂ ਕੀ ਕੀਤਾ ਹੈ ਕਿ ਤੁਹਾਡੇ ਪਿਤਾ ਜੀ ਦਾ ਬੁਖਾਰ ਉੱਤਰ ਗਿਆ ਹੈ ਉਹਨਾਂ ਨੇ ਕਿਹਾ ਮੈਂ ਤਾਂ ਸਿਰਫ ਸ਼ਰਧਾ ਨਾਲ ਬਾਣੀ ਹੀ ਪੜ੍ਹੀ ਹੈ ਜਪੁਜੀ ਸਾਹਿਬ ਜੀ ਉਹਨਾਂ ਨੇ ਕਿਹਾ ਤੁਹਾਡੀ ਬਾਣੀ ਵਿਧੀ ਸ਼ ਸ਼ਰਧਾ ਸਦਕੇ ਤੁਹਾਡੇ ਪਿਤਾ ਜੀ ਰੋਗੀ ਤੋਂ ਟਾਈਮ ਬੇਰੁਕਤ ਹੋ ਗਏ ਹਨ ਹੁਣ ਉਹ ਠੀਕ ਹੋ ਗਏ ਹਨ ਇਸ ਕਰਕੇ ਸਾਨੂੰ ਇਸ ਕਵਿਤਾ ਤੋਂ ਇਹ ਸ਼ਿਕਸ਼ਾ ਮਿਲਦੀ ਹੈ ਕਿ ਸਾਨੂੰ ਗੁਰਬਾਣੀ ਨਾਲ ਵੀ ਜੁੜਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਵਿੱਚ ਬਹੁਤ ਤਾਕਤ ਹੈ ਉਹ ਰੋਗੀਆਂ ਨੂੰ ਵੀ ਮੁਕਤ ਕਰ ਦਿੰਦੇ ਹਨ